ਕਢਾਈ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਮੈਂ ਦੱਸਣਾ ਚਾਹੁੰਦੀ ਹਾਂ ਕਿ ਆਮ ਤੌਰ 'ਤੇ ਕਢਾਈ ਦੋ ਪ੍ਰਕਾਰ ਦੀ ਹੀ ਹੁੰਦੀ ਹੈ ਜਿਸ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਹੈ ਹੱਥੀਂ ਕਢਾਈ ਅਤੇ ਦੂਸਰੇ ਨੰਬਰ 'ਤੇ ਆਉਂਦੀ ਹੈ ਮਸ਼ੀਨੀ ਕਢਾਈ ਕਢਾਈ ਹੱਥੀਂ ਕਢਾਈ ਜੋ ਕਿ ਪਹਿਲਾ ਸਮਾਂ ਸੀ ਉਹਦੇ ਵਿੱਚ ਜ਼ਿਆਦਾਤਰ ਲੋਕ ਹੱਥ ਨਾਲ ਹੀ ਕਢਾਈ ਕੱਢਦੇ ਹੁੰਦੇ ਸਨ ਹੁਣ ਕੁਝ ਸਮੇਂ ਤੋਂ ਜਦੋਂ ਦੀ ਸਾਡੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਚੁੱਕੀ ਹੈ ਬਹੁਤ ਹੀ ਤਰ੍ਹਾਂ ਦੀਆਂ ਮਸ਼ੀਨਾਂ ਆ ਚੁੱਕੀਆਂ ਹਨ ਜਿਹਨਾਂ ਵਿੱਚ ਮਸ਼ੀਨੀ ਕਢਾਈ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਹੱਥੀਂ ਕਢਾਈ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ ਇਹਦੇ ਵਿੱਚ ਹੁੰਦੀ ਇੱਕ ਤਾਂ ਹੁੰਦੀ ਹੈ ਸੂਤੀ ਕਢਾਈ ਜੋ ਕਿ ਹੱਥ ਦੇ ਨਾਲ ਲੋਕ ਕੱਢਦੇ ਹਨ ਇਹ ਬਹੁਤ ਹੀ ਇਸ ਦੇ ਨਾਲ ਬਹੁਤ ਹੀ ਸੋਹਣੇ ਸੋਹਣੇ ਪ੍ਰਕਾਰ ਦੀ ਕੜਾਈ ਕਰ ਸਕਦੇ ਹਨ ਜਿਵੇਂ ਕਿ ਫੁੱਲ ਪਾ ਸਕਦੇ ਹਨ ਕੱਪੜਿਆਂ ਦੇ ਉੱਪਰ ਇਹਨਾਂ ਨੂੰ ਕੱਢਣ ਲਈ ਇੱਕ ਅੱਡਾ ਲਗਾਉਂਦੇ ਹਨ ਜੋ ਕਿ ਜਿ ਜਿਸਦੀ ਦੋ ਸਾਈਡਾਂ 'ਤੇ ਲੱਕੜ ਲੱਗੀ ਹੁੰਦੀ ਹੈ ਅਤੇ ਜਿਸ ਦੇ ਵਿੱਚ ਕੱਪੜੇ ਨੂੰ ਬੰਨਿਆ ਜਾਂਦਾ ਹੈ ਅਤੇ ਕਢਾਈ ਕੀਤੀ ਜਾਂਦੀ ਹੈ ਅਤੇ ਦੂਸਰੀ ਹੁੰਦੀ ਹੈ ਮਸ਼ੀਨੀ ਕਢਾਈ ਮਸ਼ੀਨੀ ਕਢਾਈ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਨਾਂ ਦੇ ਵਿੱਚ ਮਸ਼ੀਨੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਇਨ ਅਤੇ ਪ੍ਰਿੰਟ ਅੱਜ ਕੱਲ੍ਹ ਮਿਲਦੇ ਹਨ ਮੈਨੂੰ ਹੱਥੀਂ ਕਢਾਈ ਆਉਂਦੀ ਹੈ